ਡਾਕਟਰ ਮੋਨਿਕਾ ਗੁਪਤਾ ਜੀ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਪ੍ਰੋਫੈਸਰ ਜਸਪਾਲ ਸਿੰਘ ਜੀ ਕੈਪਟਨ ਤਰਸੇਮਪਾਲ ਜੀ ਓਨਰੀ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਹੋ ਗਏ ਧੰਨਵਾਦ